ਹਾਂਜੀ ਮੈਨੂੰ ਵਾਤਾਵਰਨ ਦਾ ਬਹੁਤ ਸ਼ੌਂਕ ਹੈ ਮੈਂ ਵਾਤਾਵਰਨ ਵਿੱਚ ਆਸ ਪਾਸ ਆਪਣੇ ਵਾਤਾਵਰਣ ਨੂੰ ਆਪਣੇ ਪੰਛੀਆਂ ਨੂੰ ਜਾਨਵਰਾਂ ਨੂੰ ਦੇਖਦਾ ਰਹਿੰਦਾ ਹਾਂ ਅਤੇ ਮੈਨੂੰ ਇਸਦਾ ਅਨੁਭਵ ਕਰਨਾ ਬਹੁਤ ਵਧੀਆ ਲੱਗਦਾ ਹੈ ਮੈਂ ਦਿਨ ਸਵੇਰੇ ਦਿਨ ਸ਼ਾਮ ਇਹਨਾਂ ਨੂੰ ਦੇਖਦਾ ਰਹਿੰਦਾ ਹਾਂ ਇਹਨਾਂ ਦੇ ਜੀਵਨ ਬਾਰੇ ਪੜਦਾ ਰਹਿਣਾ ਹਾਂ ਇਸ ਕਰਕੇ ਮੈਂ ਕਾਫੀ ਜਿਆਦਾ ਬਰਡਿੰਗ ਕਲੱਬ ਅਤੇ ਸਮੂਹ ਵਿੱਚ ਸ਼ਾਮਿਲ ਵੀ ਹੁੰਦਾ ਰਹਿੰਦਾ ਹਾਂ ਜੋ ਕਿ ਇਸ ਪ੍ਰਕਾਰ ਹਨ ਕੁਛ ਮੇਰੇ ਦੋਸਤਾਂ ਦੇ ਮਿਲ ਕੇ ਅਸੀਂ ਇਕ ਕਲੱਬ ਬਣਾਇਆ ਹੋਇਆ ਕਲੱਬ ਬਣਾਇਆ ਹੋਇਆ ਹੈ ਅਸੀਂ ਸੂਮੋ ਬਣਾਇਆ ਹੋਇਆ ਹੈ ਉਸ ਵਿੱਚ ਅਸੀਂ ਮਹੀਨੇ ਵਿੱਚ ਇੱਕ ਵਾਰੀ ਜਾਂਦੇ ਹਾਂ ਅਸੀਂ ਵੱਖ ਵੱਖ ਜਗ੍ਹਾ ਤੇ ਜਾਨੇ ਹਾਂ ਜੰਗਲਾਂ ਵਿੱਚ ਜਾਂਦੇ ਹਾਂ ਜਿੱਥੇ ਸਾਨੂੰ ਵੱਖਰੇ ਵੱਖਰੇ ਪਰ ਪ੍ਰਕਾਰ ਦੇ ਜਾਨਵਰਾਂ ਅਤੇ ਪਛ ਪੰਛੀ ਮਿਲਦੇ ਹਨ ਅਸੀਂ ਉਹਨਾਂ ਪੰਛੀਆਂ ਵਰਨਾ ਬਾਰੇ ਆਪਸ ਵਿੱਚ ਗੱਲਬਾਤ ਕਰਦੇ ਹਾਂ ਅਸੀਂ ਇੱਕ ਦੂਜੇ ਦੀ ਸਲਾਹ ਲੈਦੇ ਹਾਂ ਦੂਜੇ ਦੀ ਰਾਏ ਲੈਦੇ ਹਾਂ ਇੱਕ ਆਪਣਾ ਤਜਰਬਾ ਸ਼ੇਅਰ ਕਰਦੇ ਹਾਂ ਆਪਣਾ ਤਜਰਬਾ ਇੱਕ ਦੂਜੇ ਨਾਲ ਆਦਾਨ ਪ੍ਰਦਾਨ ਕਰਦੇ ਹਾਂ ਇਸ ਨਾਲ ਕੀ ਹੁੰਦਾ ਸਾਡੀ ਜਿਹੜੀ ਜਾਣਕਾਰੀ ਹੈ ਵਧਦੀ ਹੈ ਅਸੀਂ ਆਪਸ ਚ ਦੇਖਦੇ ਹਾਂ ਕਿ ਉਹ ਕਿੱਦਾਂ ਜਿਉਂਦੇ ਹਨ ਉਹ ਕਿੱਦਾਂ ਰਹਿੰਦੇ ਹਨ ਉਹਨਾਂ ਦਾ ਰਹਿਣ ਸਹਿਣ ਕੀ ਹ ਉਹਨਾਂ ਦਾ ਖਾਣ ਪੀਣ ਕੀ ਹੈ ਉਹ ਕਿਸ ਤਰੀਕੇ ਨਾਲ ਜਿੰਦਗੀ ਜਿਊਂਦੇ ਹਨ ਉਹਨਾਂ ਦੀ ਜਿਹੜੀ ਜਿੰਦਗੀ ਦੇ ਮਹੱਤਵਪੂਰਨ ਕਾਰਜ ਐ ਉਹ ਕਿਸ ਤਰੀਕੇ ਨਾਲ ਕਰਦੇ ਹਨ ਉਹ ਸਵੇਰੇ ਕਿੰਨੇ ਵਜੇ ਉੱਠਦੇ ਹਨ ਉਹਨਾਂ ਦੀ ਜਿਹੜੀ ਚਹ ਚਹਿ ਚਕਾਟ ਆਵਾਜ਼ ਹੁੰਦੀ ਹ ਬੜੀ ਮਨ ਨੂੰ ਬੜੀ ਮਨਮੋਹਕ ਲੱਗਦੀ ਹੈ ਮੈਂ ਬਹੁਤ ਹੀ ਖੁਸ਼ ਹੁੰਦਾ ਹਾਂ ਉਹ ਅਵਾਜ ਸੁਣ ਕੇ ਮੈਨੂੰ ਉਹਨਾਂ ਦਾ ਜੀਵਨ ਪੜਨ ਵਿੱਚ ਬਹੁਤ ਹੀ ਮਸਤੀ ਮਿਲਦੀ ਹੈ ਇੱਕ ਵਾਰੀ ਅਸੀਂ ਵੱਖਰੇ ਕਲੱਬ ਨੂੰ ਮਿਲੇ ਸੀਗੇ ਜਿਹੜਾ ਬਰਡਿੰਗ ਕਲੱਬ ਸੀਗਾ ਉਹਨਾਂ ਨਾਲ ਅਸੀਂ ਨਾ ਸਾਡਾ ਕਲੱਬ ਸ਼ਾਮਿਲ ਹੋ ਕੇ ਅਸੀਂ ਦੂਰ ਪਹਾੜਾ ਤੇ ਗਏ ਸੀ ਅਸੀਂ ਇਹਨਾਂ ਨੂੰ ਜਾਣਕਾਰੀ ਲੈਣ ਗਏ ਸੀ ਇਹਨਾਂ ਦੀ ਬਰਡਿੰਗ ਦੀ ਉਥੇ ਅਸੀਂ ਉਥੇ ਜਾ ਕੇ ਬੜਾ ਹੀ ਮਜ਼ਾ ਕੀਤਾ ਸਾਨੂੰ ਬੜੀ ਹੀ ਜਾਣਕਾਰੀ ਸਾਡੀ ਜਾਣਕਾਰੀ ਵਿੱਚ ਵਾਧਾ ਹੋਇਆ ਸਾਡਾ ਆਨੰਦ ਵੀ ਹੋਇਆ ਮੇਰਾ ਮਨ ਮਨਮੋਹਕ ਵੀ ਬੜਾ ਹੋਇਆ